ਜੇਕਰ ਅਸੀਂ ਆਪਣੇ ਘਰ ਦੀ ਗੱਲ ਕਰੀਏ ਤਾਂ ਅਸੀਂ ਬਹੁਤ ਸਾਰੇ ਤਰੀਕਿਆਂ ਜਿਹੜੇ ਕਿ ਵਰਤਦੇ ਹਾਂ ਆਪਣੇ ਘਰ ਨੂੰ ਸਾਫ਼ ਰੱਖਣ ਦੇ ਲੀਏ ਜਿਵੇਂ ਕਿ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਝਾੜੂ ਪੋਚਾ ਤਾਂ ਆਮ ਹੀ ਹੈ ਜਿਹੜਾ ਕਿ ਘਰ ਨੂੰ ਸਾਫ਼ ਰੱਖਣ ਦੇ ਲੀਏ ਕੀਤਾ ਜਾਂਦਾ ਹੈ ਪਰ ਇਸ ਤੋਂ ਇਲਾਵਾ ਥੋੜ੍ਹੀ ਬਹੁਤ ਜਿਹੜੀ ਧੂੜ ਜੰਮ ਜਾਂਦੀ ਹੈ ਉਸ ਨੂੰ ਸਾਫ਼ ਕਰਨ ਦੇ ਲੀਏ ਹਰ ਦਸ ਪੰਦਰ੍ਹਾਂ ਦਿਨਾਂ ਦੇ ਬਾਅਦ ਜਿਹੜੀ ਕਿ ਹੈ ਡਸਟਿੰਗ ਹੈ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਅਗਰ ਕੋਈ ਘਰ ਦੇ ਵਿੱਚ ਸਪੈਸ਼ਲ ਫੰਕਸ਼ਨ ਆ ਜਾਵੇ ਜਾਂ ਕੋਈ ਵੀ ਤਿਉਹਾਰ ਆ ਜਾਵੇ ਤਾਂ ਚੰਗੀ ਤਰ੍ਹਾਂ ਘਰ ਦੀ ਜਿਹੜੀ ਹੈ ਅੰਦਰੋਂ ਸਾਫ਼ ਸਫਾਈ ਕੀਤੀ ਜਾਂਦੀ ਹੈ ਸਾਡਾ ਘਰ ਪੱਕਾ ਹੋਣ ਕਾਰਨ ਇਸ ਦੇ ਫਰਸ਼ ਦੇ ਉੱਤੇ ਤਾਂ ਕਾਓ ਡੰਕ ਜਾਂ ਫਿਰ ਜਿਸ ਨੂੰ ਗੋਹਾ ਕਿਹਾ ਜਾਂਦਾ ਹੈ ਇਸ ਦੀ ਵਰਤੋਂ ਤਾਂ ਨਹੀਂ ਕੀਤੀ ਜਾਂਦੀ ਪਰ ਘਰ ਦੇ ਪਿੱਛੇ ਕੁਛ ਕੱਚੀ ਜਗ੍ਹਾ ਉੱਤੇ ਅਸੀਂ ਗੋਹਾ ਹੈ ਜਿਹੜਾ ਉਸ ਦੇ ਨਾਲ ਲਿਪਾਈ ਜ਼ਰੂਰ ਕਰਦੇ ਹਾਂ ਅਤੇ ਜਿੱਥੇ ਅਸੀਂ ਆਪਣੇ ਪਸ਼ੂ ਜਾਂ ਫਿਰ ਆਪਣੇ ਜਿਹੜੇ ਕੁੱਤੇ ਨੇ ਉਹਨਾਂ ਦੇ ਨਾ ਉਹਨਾਂ ਨੂੰ ਨਾ ਉੱਥੇ ਲਿਜਾ ਕੇ ਰੱਖਦੇ ਹਾਂ ਅਤੇ ਉਹਨਾਂ ਦੇ ਨਾਲ ਖੇਡਣਾ ਪਸੰਦ ਕਰਦੇ ਹਾਂ